ਮੈਂ ਨਰਸਿੰਗ ਕਰਦੀ ਹਾਂ ਅਤੇ ਮੈਂ ਮਤਲਬ ਬਹੁਤ ਸਾਰੀ ਬੁੱਕਾਂ ਪੜ੍ਹਦੀ ਹਾਂ ਅਤੇ ਮੈਨੂੰ ਮਤਲਬ ਪੜ੍ਹਨ ਵਿੱਚ ਮਤਲਬ ਬਹੁਤ ਸਾਰੇ ਮਟੀਰੀਅਲ ਦੀ ਲੋੜ ਹੁੰਦੀ ਹੈ ਅਤੇ ਫਿਰ ਮਤਲਬ ਜਦੋਂ ਮਤਲਬ ਬੁੱਕ ਮੈਂ ਬੁੱਕ ਤਾਂ ਪੜ੍ਹਦੀ ਹਾਂ ਮਤਲਬ ਮੈਨੂੰ ਯਾਦ ਨਹੀਂ ਹੁੰਦਾ ਤਾਂ ਫਿਰ ਜਦ ਮੈਨੂੰ ਸਮਝ ਵੀ ਨਹੀਂ ਲੱਗਦੀ ਤਾਂ ਫਿਰ ਮੈਂ ਮਤਲਬ ਇੰਟਰਨੈੱਟ 'ਤੇ ਆ ਜਾਂਦੀ ਹਾਂ ਅਤੇ ਮੈਂ ਮਤਲਬ ਕੁਛ ਵੀ ਸਮਝਣਾ ਹੋਵੇ ਅਤੇ ਮਤਲਬ ਅਤੇ ਮੈਂ ਇੰਟਰਨੈੱਟ 'ਤੇ ਆ ਕੇ ਮਤਲਬ ਸਮਝ ਲੈਂਦੀ ਹਾਂ ਮਤਲਬ ਮੈਨੂੰ ਬਹੁਤ ਹੀ ਮਤਲਬ ਛੇਤੀ ਯਾਦ ਹੋ ਜਾਂਦਾ ਹੈ ਅਤੇ ਓਡੀਓ ਰਿਕੋਡਿੰਗ ਹੁੰਦੀ ਹੈ ਉਹ ਜੇ ਪੜ੍ਹਨ 'ਚ ਦਿੱਕਤ ਹੁੰਦੀ ਹੈ ਤਾਂ ਮੈਂ ਆਡੀਓ ਵੀ ਸੁਣਦੀ ਜੇ ਅਤੇ ਮੈਂ ਉਹਦੇ ਵਿੱਚ ਈਮੇਜਿਸ ਵਗੈਰਾ ਵੀ ਆ ਜਾਂਦੇ ਹੈ ਮਤਲਬ ਹ ਜਿਹੜਾ ਵੀ ਮਤਲਬ ਕੁਝ ਵੀ ਸਰਚ ਕਰੋ ਉਹ ਉਹਦੇ ਰੀਲੇਟਿਡ ਹੀ ਆ ਜਾਂਦਾ ਹੈ ਅਤੇ ਫਿਰ ਇਸ ਕਰਕੇ ਮੈਂ ਮਤਲਬ ਇ ਇੰਟਰਨੈੱਟ 'ਤੇ ਪੜ੍ਹਨਾ ਬਹੁਤ ਪਸੰਦ ਕਰਦੀ ਹਾਂ ਅਤੇ ਮਤਲਬ ਮਤਲਬ ਇਜੀਲੀ ਅਵੇਲਵਲ ਹੋਤਾ ਹੈ ਹੁੰਦਾ ਹੈ ਅਤੇ ਫਿਰ ਮੈਂ ਚ ਮਤਲਬ ਮੈਨੂੰ ਬਹੁਤ ਵਧੀਆ ਲੱਗਦਾ ਹੈ ਇੰਟਰਨੈੱਟ 'ਤੇ ਪੜ੍ਹਨਾ ਮੈਨੂੰ ਬਹੁਤ ਲੋੜ ਹੁੰਦੀ ਹੈ ਇੰਟਰਨੈੱਟ ਦੀ ਮੋਬਾਈਲ ਫ਼ੋਨਸ ਦੀ ਆਸਾਨੀ ਨਾਲ਼ ਮਤਲਬ ਕੁਛ ਵੀ ਸਰਚ ਕਰਨ ਦੀ